ਪਿਛਲੇ ਹਫਤੇ ਮੇਰੇ ਔਫਿਸ ਵਿੱਚ ਇੱਕ ਨਿੱਜੀ ਮੀਟਿੰਗ ਸੀ ਜਿਸ ਵਿੱਚ ਮੈਂ ਇੱਕ ਰੈਸਟੋਰੈਂਟ ਤੋਂ ਭੋਜਨ ਡਿਲੀਵਰੀ ਕਰਵਾਇਆ ਸੀ ਉਹ ਭੋਜਨ ਵਿੱਚ ਬਹੁਤ ਸਾਰੀਆਂ ਡਿਫਰੈਂਟ ਆਈਟਮਾਂ ਸੀ ਜਿਵੇਂ ਪਨੀਰ ਦੀ ਸਬਜ਼ੀ ਦਾਲ ਮੱਖਣੀ ਤੰਦੂਰੀ ਰੋਟੀ ਨਾਨ ਰਾਈਸ ਇਹ ਔਰਡਰ ਮੈਂ ਇੱਕ ਪਿਕਅਪ ਲਈ ਆਰਡਰ ਕੀਤਾ ਸੀ ਅਤੇ ਇਹ ਮੇਰੇ ਨ ਔਫਿਸ ਦੇ ਉਦੇਸ਼ ਲਈ ਕੀਤਾ ਸੀ ਇਸ ਇਸ ਰੈਸਟੋਰੈਂਟ ਤੋਂ ਮੈਨੂੰ ਆਪਣੀ ਇੱਕ ਰਸੀਦ ਦੀ ਲੋੜ ਹੈ ਤਾਂ ਕਿ ਮੈਂ ਆਪਣੇ ਔਫਿਸ ਦੇ ਤੋਂ ਇਸ ਸੰਬੰਧੀ ਖਰਚਾ ਲੈ ਸਕਾਂ ਇਹ ਔਰਡਰ ਮੈਂ ਤੇਈ ਗਿਆਰਾਂ ਨੂੰ ਤੇਈ ਗਿਆਰਾਂ ਦੋ ਹਜ਼ਾਰ ਬਾਈ ਨੂੰ ਔਰਡਰ ਕੀਤਾ ਸੀ ਅਤੇ ਇਸ ਦੀ ਮੈਨੂੰ ਰਸੀਦ ਦੀ ਕਾਪੀ ਚਾਹੀਦੀ ਹੈ ਤਾਂ ਕਿ ਮੈਂ ਇਹ ਆਪਣਾ ਖਰਚਾ ਆਪਣੇ ਦਫਤਰ ਤੋਂ ਪ੍ਰਾਪਤ ਕਰ ਸਕਾਂ ਅਤੇ ਇਹਦਾ ਸਾਰਾ ਰਿਕੋਰਡ ਮੈਂ ਸਾਂਭ ਕੇ ਰੱਖ ਸਕਾਂ